ਪੰਜਾਬ ਦੇ ਕਾਰੋਬਾਰ 'ਤੇ ਪ੍ਰਵਾਸ ਦਾ ਬਹੁਤ ਵੱਡਾ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਪੰਜਾਬ ਦੇ ਲੋਕ ਇੱਥੋਂ ਪ੍ਰਵਾਸ ਕਰਕੇ ਬਾਹਰ ਜਾਈ ਜਾ ਰਹੇ ਨੇ ਅਤੇ ਇੱਥੇ ਪੰਜਾਬ ਦੇ ਵਿੱਚ ਜਿਹੜੇ ਨੇ ਬਾਹਰਲੇ ਲੋਕ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਆ ਉਹਦਾ ਮੁੱਖ ਕਾਰਨ ਇਹ ਹੈ ਕਿਉਂਕਿ ਇੱਥੇ ਕਾਰੋਬਾਰ ਦੇ ਲਈ ਕੋਈ ਵਧੀਆ ਤਰੀਕੇ ਨਾਲ ਕੋਈ ਵੀ ਸੋਚ ਨਹੀਂ ਬਣਾਈ ਜਾ ਰਹੀ ਹੈ ਨਾ ਹੀ ਕਾਰੋਬਾਰ ਨੂੰ ਤਰੀ ਡਿਵੈਲਪ ਕੀਤਾ ਜਾ ਰਿਹਾ ਹੈ ਪੰਜਾਬ ਵਿੱਚੋਂ ਜਿੰਨਾ ਵੀ ਕਾਰੋਬਾਰ ਸੀ ਉਹ ਹੁਣ ਨਾਲ ਦੀਆਂ ਰ ਸਟੇਟਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ ਇਹਦੇ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਨਵੇਂ ਨਵੇਂ ਪ੍ਰੋਜੈਕਟ ਲਗਾਏ ਜਾਣ ਪੰਜਾਬ ਵਿੱਚ ਤਾਂ ਜੋ ਜਿਹੜੇ ਯੂਥ ਹੈ ਉਹਦਾ ਪ੍ਰਵਾਸ ਰੋਕਿਆ ਜਾ ਸਕੇ ਸਾਰੀ ਦੀ ਸਾਰੀ ਪੰਜਾਬ ਦੀ ਯੂਥ ਜਿਹੜੀ ਹੈ ਉਹ ਬਾਹਰਲੇ ਮੁਲਕਾਂ ਵਿੱਚ ਜਾਣਾ ਪਸੰਦ ਕਰ ਰਹੀ ਹੈ ਜੋ ਕਿ ਪੰਜਾਬ ਦੇ ਲਈ ਬਹੁਤ ਹੀ ਹਾਨੀਕਾਰਕ ਸਿੱਧ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਧੰਨਵਾਦ